ਕੀ ਤੁਸੀਂ ਕਾਰੋਬਾਰਾਂ ਬਾਰੇ ਗੱਲ ਕਰ ਸਕਦੇ ਹੋ ਜੋ ਪੇਂਡੂ ਖੇਤਰ ਵਿੱਚ ਸਥਾਨਕ ਖੇਤੀਬਾੜੀ ਉਦਯੋਗ ਨੂੰ ਸਮਰਥਨ ਦੇਣ ਲਈ ਸਥਾਪਿਤ ਕੀਤੇ ਗਏ ਹਨ ਜਿਵੇਂ ਕਿ ਖੇਤੀਬਾੜੀ ਸਪਲਾਈ ਸਟੋਰਾਂ ਦੀ ਖੇਤੀਬਾੜੀ ਸਪਲਾਈ ਸਟੋਰ ਦੇ ਵਿੱਚ ਤੁਹਾਨੂੰ ਪਤਾ ਹੀ ਜਿਵੇਂ ਕਿ ਪਿੰਡਾਂ ਵਿੱਚ ਦੁਕਾਨਾਂ ਹੁੰਦੀਆਂ ਨੇ ਜਿਵੇਂ ਵੀ ਆਪਾਂ ਕੋਈ ਬੀਜ ਬੋਨ ਕੋਈ ਬੀਜ ਚਾਹੀਦਾ ਆਪਾਂ ਨੂੰ ਤਾਂ ਅਲੱਗ ਅਲੱਗ ਸਟੋਰ ਹੁੰਦੇ ਨੇ ਅੱਜਕੱਲ੍ਹ ਤਾਂ ਗਵਰਮੈਂਟ ਵੀ ਆਪਣੇ ਸਟੋਰ ਖੋਲ੍ਹਣ ਲੱਗ ਗਈ ਤਾਂ ਕਿ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਬੜੀ ਇਹ ਖੇਤੀ

ਲੋਕ ਜਿਹੜੀ ਸਰਕਾਰ ਹੈ ਸਾਰੇ ਖੁਦ ਇਹ ਕੰਮ ਸਰਕਾਰ ਨੇ ਖੁਦ ਇਹ ਕੰਮ ਚੁੱਕਿਆ ਇਹ ਵਧੀਆ ਕੰਮ ਕਿ ਅਸੀਂ ਖੁਦ ਇੱਕ ਵਧੀਆ ਕੈਟਾਗਰੀ ਦੇ ਜਿਹੜੇ ਵਧੀਆ ਬੀਜ ਨੇ ਉਹ ਕਿਸਾਨਾਂ ਤੱਕ ਪਹੁੰਚਾਈਏ ਤਾਂ ਸਰਕਾਰ ਵੀ ਅੱਜ ਕੱਲ ਪਿੰਡਾਂ ਦੇ ਵਿੱਚ ਆਪਣੇ ਆਪਣੇ ਸਟੋਰ ਖੋਲ੍ਹਦੀ ਹੈ ਇਸ ਤੋਂ ਇਲਾਵਾ ਹੋਰ ਪ੍ਰਾਈਵੇਟ ਸੈਕਟਰ ਵੀ ਸਟੋਰ ਹੁੰਦੇ ਨੇ ਉੱਥੇ ਪਰ ਜਿਹੜੇ ਪ੍ਰਾਈਵੇਟ ਸੈਕਟਰ ਨੇ ਤੁਹਾਨੂੰ ਪਤਾ ਉਹ ਲਾਭ 'ਤੇ ਜ਼ਿਆਦਾ ਕੰਮ ਕਰਦੇ ਨੇ ਉਹਨਾਂ ਨੂੰ ਕੁਆਲਿਟੀ ਦਾ ਇੰਨਾ ਕੁਛ ਹੁੰਦਾ ਨਹੀਂ ਪਸ਼ੂ ਧਨ ਸਪਲਾਈ ਸਟੋਰ ਪਸ਼ੂ ਧਨ ਵਾਲੇ ਵੀ ਮਿਲ ਜਾਂਦੇ ਨੇ ਬਟ ਉਹ ਇੱਕ ਸਪੈਸੀਫਿਕ ਏਰੀ ਸਾਰੇ ਏਰੀਏ 'ਚ ਤਾਂ ਨਹੀਂ ਪਾਏ ਜਾਂਦੇ ਬਟ ਜਿਵੇਂ ਕਿ ਸਾਡੇ ਰੋਪੜ ਇੱਧਰ ਸ ਮੈਂ ਜਿਵੇਂ ਕਪੂਰਥਲਾ ਸ਼ਹਿਰ ਮੈਨੂੰ ਪਸ਼ੂ ਧਨ ਸਟੋਰ ਨੇੜੇ ਤੇੜੇ ਤਾਂ ਨਹੀਂ ਮਿਲਦਾ ਕਿ ਮੈਨੂੰ ਇਸ ਤੋਂ ਇਲਾਵਾ ਕਿ ਨਵਾਂ ਸ਼ਹਿਰ ਦੇ ਨੇੜੇ ਤੇੜੇ ਜਾਣਾ ਪੈਂਦਾ ਉੱਥੇ ਉੱਥੇ ਇਹਨਾਂ ਦੀ ਰਿਮਾਂਡ ਜ਼ਿਆਦਾ ਹੈ ਅਤੇ ਕਿਸਾਨ ਬਾਜ਼ਾਰ ਕਿਸਾਨ ਬਾਜ਼ਾਰ ਲੱਗਦੇ ਰਹਿੰਦੇ ਨੇ ਜੀ ਹਰ ਮਹੀਨੇ ਦੇ ਇੱਕ ਦਿਨ ਦੇ ਵਿੱਚ ਸਾਡੇ ਜਿਹੜਾ ਉਰੇ ਮੈਦਾਨ ਹੈ ਇੱਕ ਉੱਥੇ ਸ਼ਾਲੀਮਾਰ ਗਾਰਡਨ ਆ ਕਪੂਰਥਲਾ ਦਾ ਉੱਥੇ ਕਈ ਵਾਰ ਕਿਸਾਨ ਮੇਲਾ ਵੀ ਲੱਗਦਾ ਕਿਸਾਨ ਬਾਜ਼ਾਰ ਹੁੰਦੇ ਨੇ ਜਿੱਥੇ ਅਲੱਗ ਅਲੱਗ ਖੇਤੀਬਾੜੀ ਕਰਨ ਦੀ ਅਲੱਗ ਅਲੱਗ ਔਜਾਰ ਮਿਲਦੇ ਨੇ ਠੀਕ ਹੈ ਜੀ ਖੇਤੀਬਾੜੀ ਸੈਰ ਸਪਾਟਾ ਸੰਚਾਲਨ ਖੇ ਖੇਤੀਬਾੜੀ ਸੈਰ ਸਪਾਟਾ ਸੰਚਾਲਨ ਤਾਂ ਮੈਨੂੰ ਇ ਇਹਦੇ ਬਾਰੇ ਤਾਂ ਨਹੀਂ ਕੋਈ ਜਾਣਕਾਰੀ ਹੈ ਨਹੀਂ ਜੀ ਹਾਂ ਪਰ ਕਿਸਾਨ ਕਿਸਾਨ ਬਾਜ਼ਾਰ ਮੇਨੇ ਕਾਫੀ ਬਾਰ ਮੈਂ ਗਿਆ ਵੀ ਹੋਇਆ ਕਈ ਖੇਤੀਬਾੜੀ ਦੇ ਔਜਾਰ ਵੀ ਖਰੀਦੇ ਹੋਏ ਨੇ ਕਹੀ ਹੋ ਗਈ ਠੀਕ ਹੈ ਜੀ ਇਸ ਤੋਂ ਇਲਾਵਾ ਖੇਤੀਬਾੜੀ ਦੇ ਵਿੱਚ ਜੋ ਤਕਨੀਕਾਂ ਜੋ ਯੂਜ਼ ਹੁੰਦੀਆਂ ਨੇ ਉਹ ਵੀ ਉੱਥੇ ਸਿਖਾਈਆਂ ਜਾਂਦੀਆਂ ਨੇ ਇਹ ਵਧੀਆ ਇੱਕ ਐਜੂਕੇਸ਼ਨ ਇਹ ਪੜ੍ਹਾਈ ਦੇ ਵਿੱਚ ਵੀ ਵਧੀਆ ਸਾਨੂੰ ਹੈਲਪ ਕਰਦੀਆਂ ਨੇ ਮੈਂ ਆਪਣੇ ਡੈਡੀ ਜੀ ਨਾਲ ਹਮੇਸ਼ਾ ਜਾਂਦਾ ਅਤੇ ਮੈਨੂੰ ਵਧੀਆ ਲੱਗਦਾ ਕਿ ਮੈਂ ਇਹੀ ਚੀਜ਼ਾਂ ਨਵੀਆਂ ਤੋਂ ਨਵੀਆਂ ਚੀਜ਼ਾਂ ਸਿੱਖਾਂ ਇਸ ਤੋਂ ਇਲਾਵਾ ਖੇਤੀਬਾੜੀ ਕਾਂਟਰੈਕਟਿੰਗ ਸੇਵਾਵਾਂ ਨੂੰ ਇਸ ਕੌਨ ਕਾਂਟਰੈਕਟਿੰਗ ਸੇਵਾਵਾਂ ਠੀਕ ਨੇ ਅੱਜ ਕੱਲ੍ਹ ਤਾਂ ਪਿੰਡਾਂ ਦੇ ਵਿੱਚ ਹਾਂ ਪਰ ਲੋਕ ਚਾਹੁੰਦੇ ਨੇ ਕਿ ਲੋਕ ਘੱਟ ਪੰਜਾਬੀ ਜਿਹੜੇ ਪੰਜਾਬ ਦੇ ਵਿੱਚ ਟਰੈਂਡ ਹੈਗਾ ਹੈ ਕਿ ਖੁਦ ਘੱਟ ਕੰਮ ਕਰਨ ਇਸ ਲਈ ਹੋਰਾਂ ਨੂੰ ਹਾਇਰ ਕਰ ਲੈ ਲੈਂਦੇ ਨੇ ਕਿ ਤੁਸੀਂ ਸਾਡੀ ਜਗ੍ਹਾ 'ਤੇ ਤੁਸੀਂ ਕੰਮ ਕਰ ਲਿਓ ਇਹ ਤਾਂ ਤਾਂ ਕਾਂਟਰੈਕਟਿੰਗ ਦੀ ਜਿਹੜੀ ਸੇਵਾ ਨੇ ਇਹ ਵੀ ਕਾਫੀ ਪ੍ਰਚਲਿਤ ਨੇ ਅੱਜ ਕੱਲ੍ਹ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬੀ ਜ਼ਿਆਦਾਤਰ ਹੀ ਬਾਹਰ ਵੀ ਜਾ ਰਹੇ ਨੇ ਤਾਂ ਉਹ ਜਿਹੜੇ ਬਾਹਰ ਜਾਂਦੇ ਤਾਂ ਖੁਦ ਦੇ ਜਿਹੜੇ ਉਰੇ ਖੇਤ ਨੇ ਉਹਨਾਂ ਦੇ ਉਹ ਹੋਰ ਲੋਕਾਂ ਨੂੰ ਕੋਨਟਰੈਕਟ 'ਤੇ ਦੇ ਦਿੰਦੇ ਨੇ ਤਾਂ ਕਿ ਅਸੀਂ ਪੈਸੇ ਵੀ ਕਮਾ ਸਕੀਏ ਨਾਲ ਨਾਲ ਬਸ ਇੰਨਾ ਹੀ ਮੈਨੂੰ ਇਹਦੇ ਬਾਰੇ ਪਤਾ